ਸਾਨੂੰ ਜ਼ਮੀਨ ਖਰੀਦਣ ਜਾਂ ਵੇਚਣ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਸਾਨੂੰ ਲੋਕਾਂ ਦੇ ਅੱਗੇ ਪਿੱਛੇ ਫਿਰਨਾ ਪੈਂਦਾ ਹੈ ਜਦੋਂ ਅਸੀਂ ਆਪਣੀ ਜ਼ਮੀਨ ਵੇਚਦੇ ਹਾਂ ਤਾਂ ਜੋ ਖਰੀਦਣ ਵਾਲੇ ਹੁੰਦੇ ਨੇ ਉਹ ਸਮੇਂ ਸਿਰ ਰਜਿਸਟਰੀ ਨਹੀਂ ਕਰਾਉਂਦੇ ਉਹਨਾਂ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਵਜ੍ਹਾ ਕਾਰਨ ਆਪਣਾ ਘਰ ਛੱਡ ਕੇ ਕਈਆਂ ਨੂੰ ਰੁਲਣਾ ਪੈਂਦਾ ਹੈ ਕਿਰਾਇਆਂ 'ਤੇ ਕੁਝ ਲੋਕ ਤਾਂ ਕਈ ਕਈ ਸਾਲ ਬਗੈਰ ਰਜਿਸਟਰੀ ਵਾਲੇ ਘਰਾਂ ਵਿੱਚ ਹੀ ਰਹੀ ਜਾਂਦੇ ਨੇ ਅਤੇ ਕਈ ਤਾਂ ਬਗੈਰ ਰਜਿਸਟਰੀ ਤੋਂ ਹੀ ਪਲਾਟ 'ਤੇ ਕਬਜ਼ਾ ਕਰ ਲੈਂਦੇ ਨੇ ਅਤੇ ਉੱਤੇ ਫਿਰ ਵੱਡੀ ਵੱਡੀ ਇਮਾਰਤਾਂ ਪਾਉਣੀਆਂ ਸ਼ੁਰੂ ਕਰ ਲੈਂਦੇ ਨੇ ਇਹ ਸਭ ਗੈਰ ਕਾਨੂੰਨੀ ਕੰਮ ਨੇ ਇਹਨਾਂ ਕਰਕੇ ਆਮ ਜਨਤਾ ਨੂੰ ਬਹੁਤ ਦਿੱਕਤ ਆਉਂਦੀ ਹੈ